ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜਿਹੜਾ ਸਿੱਧੂ ਮੂਸੇਵਾਲਾ ਹਾਂਜੀ ਹਾਂਜੀ ਸਿੱਧੂ ਮੂਸੇਵਾਲਾ ਜਿਹੜਾ ਉਹ ਮੂਸੇ ਪਿੰਡ ਦਾ ਹੀ ਹੈ ਜੀ ਅਤੇ ਉਹ ਬਿਲਕੁਲ ਐਵੇਂ ਸਿੰਪਲ ਬੰਦਾ ਇੰਨਾ ਵੱਡਾ ਸਿੰਗਰ ਹੋਣ ਦੇ ਬਾਵਜੂਦ ਵੀ ਉਹ ਆਪਣੇ ਪਿੰਡ ਦੇ ਵਿੱਚ ਰਹਿ ਰਿਹਾ ਸਾਰੇ ਮਤਲਬ ਪਿੰਡ ਵਾਲਿਆਂ ਨੂੰ ਬਹੁਤ ਹੀ ਪਸੰਦ ਕਰਦਾ ਪਿੰਡ ਵਾਲੇ ਵੀ ਉਹਨੂੰ ਬਹੁਤ ਪਸੰਦ ਕਰਦੇ ਨੇ ਪੂਰਾ ਉਹ ਐਵੇਂ ਕੋਈ ਹਾਈਫਾਈ ਨਹੀਂ ਰਹਿੰਦਾ ਆਪਣੇ ਖੇਤਾਂ ਦੇ ਵਿੱਚ ਵੀ ਕੰਮ ਕਰਦਾ ਅਤੇ ਨਾਲ ਦੀ ਨਾਲ ਆਪਣੇ ਮਾਂ ਬਾਪ ਦੀ ਵੀ ਸੇਵਾ ਕਰਦਾ ਸਾਰੇ ਬੱਚੇ ਉਹਦੇ ਫੈਨ ਨੇ ਸਾਰੇ ਪਿੰਡ ਵਾਲਿਆਂ ਨੂੰ ਵੀ ਉਹ ਵਧੀਆ ਪੂਰੀ ਰਿਸਪੈਕਟ ਕਰਦਾ ਸੇਵਾ ਕਰਦਾ ਬੱਚੇ ਵੀ ਉਹਨੂੰ ਬਹੁਤ ਪਸੰਦ ਕਰਦੇ ਨੇ ਅਤੇ ਇੰਨਾ ਵੱਡਾ ਸਿੰਗਰ ਹੋਣ ਦੇ ਬਾਵਜੂਦ ਵੀ ਉਹਨੇ ਕਦੇ ਆਪਣਾ ਪਿੰਡ ਨਹੀਂ ਛੱਡਿਆ ਕਿਸੇ ਬਾਹਰ ਸਟੇਟਸ ਦੇ ਵਿੱਚ ਬਾਹਰ ਕੰਟਰੀਆਂ ਦੇ ਵਿੱਚ ਜਾਂਦਾ ਲਾਈਵ ਸ਼ੋਅ ਕਰਦਾ ਉੱਥੇ ਵੀ ਲੋਕ ਉਹਨੂੰ ਬਹੁਤ ਪਸੰਦ ਕਰਦੇ ਨੇ ਪਰ ਉਹਦੇ ਨਾਲ ਇੱਕ ਹੁਣ ਜਿਹੜੇ ਪਿੱਛੇ ਜਿਹੇ ਮਾੜੀ ਘਟਨਾ ਵਾਪਰੀ ਹੈ ਨਾਲੇ ਇੰਨਾ ਵੱਡਾ ਸਿੰਗਰ ਹੋਣ ਦੇ ਬਾਵਜੂਦ ਵੀ ਉਹਨੂੰ ਗੋਲੀ ਮਾਰਤੀ ਵਿਚਾਰਾ ਮਰ ਗਿਆ ਇੰਨੀ ਭਰੀ ਜਵਾਨੀ ਦੇ ਵਿੱਚ ਮਰ ਗਿਆ ਪਰ ਜਾਣਾ ਤਾਂ ਨਹੀਂ ਚਾਹੀਦਾ ਸੀ ਉਹਨੂੰ ਹਲੇ ਉਹ ਘਰ ਲੋੜ ਸੀ ਉਹਦੀ ਮਾਂ ਬਾਪ ਨੂੰ ਵੀ ਉਹਦੀ ਲੋੜ ਸੀਗੀ ਪਰ ਫਿਰ ਵੀ ਉਹ ਇੰਨੀ ਜਲਦੀ ਚਲਾ ਗਿਆ ਪਰ ਫਿਰ ਵੀ ਉਹ ਆਪਣੇ ਜਾਣ ਤੋਂ ਬਾਅਦ ਵੀ ਪਰ ਉਹ ਆਪਣੀ ਛਾਪ ਛੱਡ ਗਿਆ ਲੋਕਾਂ 'ਤੇ ਹਾਂ ਵੀ ਲੋਕ ਉਹਨੂੰ ਹਾਲੇ ਵੀ ਦਿਲੋਂ ਯਾਦ ਕਰਦੇ ਨੇ ਉਹਦੀ ਮਤਲਬ ਯਾਦ ਦੇ ਵਿੱਚ ਸਾਰੇ ਉਹਨਾਂ ਦੇ ਪਿੰਡ ਵਿੱਚ ਇੱਕ ਸਮਾਧੀ ਬਣੀ ਹੋਈ ਹੈ ਜਿੱਥੇ ਉਹਦੀ ਬਰਸੀ ਮਨਾਉਂਦੇ ਆ ਹਾਂਜੀ ਓਕੇ ਜੀ ਓਕੇ ਹਾਂਜੀ ਤੁਸੀਂ ਆਇਓ ਜ਼ਰੂਰ ਪਿੰਡ ਉੱਥੇ ਦੇਖ ਕੇ ਜਾਇਓ ਉਹਦੀ ਸਮਾਧ ਵੀ ਦੇਖਿਓ ਮੇਲੇ 'ਤੇ ਵੀ ਆਇਓ ਜ਼ਰੂਰ ਹਾਂਜੀ ਓਕੇ ਜੀ ਓਕੇ